ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਬਠਿੰਡੇ ਤੋਂ ਗੱਲ ਕਰ ਰਹੇ ਹਾਂ ਸਰ ਅਸੀਂ ਨਾ ਬਠਿੰਡਾ ਦੇ ਵਿੱਚ ਘੁੰਮਣ ਆਏ ਹੋਏ ਸੀ ਅਤੇ ਅਸੀਂ ਤੁਹਾਡੇ ਤੋਂ ਥੋੜ੍ਹੀ ਜਿਹੀ ਨੌਲੇਜ ਲੈਣੀ ਸੀਗੀ ਬਠਿੰਡਾ ਦੇ ਵਿੱਚ ਵਧੀਆ ਪਲੇਸਿਜ਼ ਕਿਹੜੀਆਂ ਜਿੱਥੇ ਵੀ ਮਤਲਬ ਕਿ ਅਸੀਂ ਘੁੰਮ ਸਕਦੇ ਹਾਂ ਬਸ ਬਠਿੰਡੇ ਜਿਲ੍ਹੇ ਦੇ ਵਿੱਚ ਹੀ ਕਿਤੇ ਵੀ ਦੱਸ ਦਿਓ ਵੀ ਜਿੱਥੇ ਵਧੀਆ ਪਲੇਸਿਸ ਹੋਣ ਇਹੋ ਜਿਹੀਆਂ ਅੱਛਾ ਜੀ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ

ਅਤੇ ਉੱਥੇ ਗੁਰਦੁਆਰਾ ਸਾਹਿਬ ਹੈ ਸਰ ਠੀਕ ਹੈ ਸਰ ਇੱਕ ਦੂਜੀ ਗੱਲ ਐਂ ਪੁੱਛਣੀ ਸੀਗੀ ਵੀ ਆਪਣੇ ਜਿਹੜੀਆਂ ਝੀਲਾਂ ਬਾਰੇ ਸੁਣਿਆ ਸੀ ਇਹ ਕਿੱਥੇ ਜਿਹੇ ਨੇ

ਠੀਕ ਹੈ ਜੀ ਠੀਕ ਹੈ ਸਰ ਅਤੇ ਹੋਰ ਕੋਈ ਸਰ ਹੋਰ ਕੋਈ ਪਲੇਸ ਹੈ ਠੀਕ ਹੈ ਸਰ

ਅਤੇ ਸਰ ਮੈਂ ਪੁੱਛਦਾ ਸੀਗਾ ਜਿਹੜਾ ਇੱਕ ਅਸੀਂ ਐਂ ਵੀ ਸੁਣਿਆ ਸੀਗਾ ਵੀ ਇੱਥੇ ਜੂਅ ਵਗੈਰਾ ਵੀ ਹੈਗੀ ਹੈ ਇਸ ਡਿਸਟ੍ਰਿਕਟ ਦੇ ਵਿੱਚ

ਠੀਕ ਹੈ ਸਰ ਠੀਕ ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ ਸੋ ਮਚ